ਹੈਲੋ ਸੱਸਰੀਕਾਲ ਜੀ ਹਾਂਜੀ ਆਜ ਤੱਕ ਤੋ ਬੋਲਦੇ ਆ ਮੀਡੀਆ ਵਾਲੇ ਆਜ ਤੱਕ ਚੈਨਲ ਤੋਂ ਹਾਂਜੀ ਤੁਸੀਂ ਡਿਪਾਰਟਮੈਂਟ ਤੋਂ ਬੋਲਦੇ ਓ ਹਾਂਜੀ ਅਸੀਂ ਥੋੜੀ ਜਿਹੀ ਨਾ ਜਾਣਕਾਰੀ ਲੈਣੀ ਸੀ ਅਸੀਂ ਇੱਕ ਆਰਟੀਕਲ ਤਿਆਰ ਕਰ ਰਹੇ ਆਂ ਪੰਜਾਬ ਦੇ ਦਰਿਆਵਾਂ ਦੇ ਨਦੀਆਂ ਤੇ ਪਰ ਇਹ ਥੋੜੀ ਦੱਸਣ ਦੀ ਕਿਰਪਾਲਤਾ ਕਰੂਗੇ ਜੀ ਆਹ ਜਿਹੜਾ ਆਪਣੇ ਡੈਮਾਂ ਦਾ ਪਾਣੀ ਆ ਉਹ ਸੁੱਕਦਾ ਜਾ ਰਿਹਾ ਨਾਲੇ ਵਹਾਅ ਬਹੁਤ ਘੱਟ ਰਿਹਾ ਕੀ ਕਾਰਨ ਐ ਜੀ ਇਹ ਪੁੱਛਣਾ

ਕਿੰਨੇ ਦਰਿਆ ਸੀ ਤੇ ਹੁਣ ਦੇਖੋ ਘੱਟ ਗਏ ਦੂਸਰੇ ਡੈਮ ਵੀ ਸਾਈਡ ਚਲੇ ਗਏ ਵੀ ਥੋੜਾ ਜਿਹਾ ਅਸੀਂ ਦਿੱਕਤਾ ਹਾਂਜੀ ਹਾਂਜੀ ਹਾਂਜੀ ਪੰਜਾਬ 'ਚ ਕਿੰਨੇ ਚੱਲ ਰਹੇ ਨੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ